ਭੰਗੜੇ ਦੀ ਬਹੁਤ ਮਹੱਤਤਾ ਹੈ ਭੰਗੜਾ ਪੰਜਾਬ ਦਾ ਪ੍ਰਸਿੱਧ ਲੋਕ ਨਾਚ ਹੈ ਪੰਜਾਬ ਦੇ ਹਰ ਪ੍ਰੋਗਰਾਮ ਮੌਕਿਆਂ ਅਫਸਰਾਂ 'ਤੇ ਭੰਗੜੇ ਨੂੰ ਪਹਿਲ ਦਿੱਤੀ ਜਾਂਦੀ ਹੈ ਕਈ ਵਿਆਹ ਸ਼ਾਦੀਆਂ ਕਈ ਜਨਮ ਦਿਨ ਦੇ ਮੌਕਿਆਂ ਅਤੇ ਕਈ ਹੋਰ ਪ੍ਰੋਗਰਾਮ ਜੋ ਖੁਸ਼ੀ ਨਾਲ ਸੰਬੰਧਿਤ ਹੁੰਦੇ ਹਨ ਉੱਥੇ ਵੀ ਭੰਗੜਾ ਪਾਇਆ ਜਾਂਦਾ ਹੈ ਭੰਗੜਾ ਸਿਰਫ ਪੰਜਾਬ ਵਿੱਚ ਹੀ ਪ੍ਰਚਲਿਤ ਨਹੀਂ ਪੂਰੀ ਦੁਨੀਆ ਵਿੱਚ ਹੀ ਨਾ ਪ੍ਰਚਲਿਤ ਹੈ ਭੰਗੜੇ ਨੂੰ ਲੋਕ ਬਹੁਤ ਪਸੰਦ ਕਰਦੇ ਹਨ ਭੰਗੜਾ ਪੰਜਾਬੀਆਂ ਦੀ ਆਨ ਬਾਨ ਸ਼ਾਨ ਹੈ ਪੰਜਾਬੀ ਭੰਗੜੇ ਬਹੁਤ ਪ੍ਰਚਲਿਤ ਹਨ ਭੰਗੜਾ ਸਾਡੇ ਵਿੱਚ ਉਤਸ਼ਾਹ ਉਮੰਗ ਚਾਅ ਆਦਿ ਪੈਦਾ ਕਰਦਾ ਹੈ ਜਿਸ ਨਾਲ ਸਾਡਾ ਸਰੀਰ ਤੰਦਰੁਸਤ ਸਵਸਥ ਬਣਦਾ ਹੈ